ਸਾਡੇ ਸਥਾਨ ਉੱਤੇ ਮੂਲ ਕਲਾ ਪੇਂਟਿੰਗ ਮੂਰਤੀ ਅਤੇ ਛਪਾਈ ਹੈ ਇਸ ਖੇਤਰ ਵਿੱਚ ਅਸੀਂ ਬਹੁਤ ਜ਼ਿਆਦਾ ਤੇਜ਼ ਅਤੇ ਵਧੀਆ ਹਨ ਹਰ ਸਾਲ ਬਹੁਤ ਸਾਰੇ ਬੱਚੇ ਪੇਟਿੰਗ ਮੂਰਤੀ ਅਤੇ ਛਪਾਈ ਸਿੱਖਣ ਕੋਲਜਾਂ ਵਿੱਚ ਦਾਖਲਾ ਲੈਂਦੇ ਹਨ ਅਤੇ ਬਾਹਰੋਂ ਵੀ ਕੁਛ ਸਿੱਖਦੇ ਹਨ ਇਨ੍ਹਾਂ ਨੂੰ ਇਨ੍ਹਾਂ ਦੀ ਸਿਖਾਏ ਵੈਸੇ ਤਾਂ ਸ਼ੁਰੂ ਸ਼ੁਰੂ ਵਿੱਚ ਬਹੁਤ ਮੁਸ਼ਕਿਲ ਹੁੰਦੀ ਹੈ ਪਰ ਜਦੋਂ ਹੱਥ ਉੱਤੇ ਕਲਾ ਚੜ੍ਹ ਜਾਂਦੀ ਹੈ ਤਾਂ ਇਹ ਬਹੁਤ ਹੀ ਜ਼ਿਆਦਾ ਆਸਾਨ ਬਣ ਜਾਂਦੀ ਹੈ ਹੋਰ ਸਥਾਨ ਉੱਤੇ ਤਾਂ ਵੈਸੇ ਬਹੁਤ ਘੱਟ ਲੋਕ ਹੀ ਪੇਂਟਿੰਗ ਅਤੇ ਛਪਾਈ ਸਿੱਖਦੇ ਹਨ ਪਰ ਸਾਡੇ ਜ਼ਿਲ੍ਹੇ ਰੂਪਨਗਰ ਵਿੱਚ ਇਸ ਦਾ ਬਹੁਤ ਬਹੁਤ ਵੱਡਾ ਖੇਤਰ ਹੈ ਅਤੇ ਬਾਹਰ ਉੱਤੋਂ ਵੀ ਵਿਦਿਆਰਥੀ ਇਸ ਸੈਂਟਰਾਂ ਵਿੱਚ ਅਡਮੀਸ਼ਨ ਲੈ ਕੇ ਇਹ ਕਲਾਵਾਂ ਸਿੱਖਦੇ ਹਨ ਅਤੇ ਪੈ ਅਤੇ ਆਪਣੇ ਆਪ ਨੂੰ ਕਮਾਊ ਬਣਾਉਂਦੇ ਹਨ ਇਨ੍ਹਾਂ ਕਲਾਵਾਂ ਨੂੰ ਸਿੱਖ ਕੇ